ਹੈਲੋ ਨਮਸਕਾਰ ਜੀ ਰਾਜੂ ਟੂਲ ਟਰੈਵਲ ਤੋਂ ਗੱਲ ਕਰ ਰਹੇ ਹੈ ਜੀ ਸਰ ਇੱਕ ਹੋਲਾ ਮਹੱਲਾ ਆ ਰਿਹਾ ਜੀ ਅਨੰਦਪੁਰ ਸਾਹਿਬ ਵੈਸੇ ਕੀ ਕੀ ਦੇਖਣ ਨੂੰ ਮਿਲ ਸਕਦਾ ਜੀ ਇੱਥੇ ਹਾਂਜੀ ਹਾਂਜੀ ਹਾਂਜੀ ਹਾਂਜੀ ਅਸੀਂ ਜਾਣਾ ਹੈ ਜੀ ਬਸ ਬਾਰਾ ਤਰੀਕ ਨੂੰ ਜਾਣਾ ਜੀ ਬਸ ਚਾਰ ਪੰਜ ਦਿਨ ਦਾ ਕਰ ਲਓ ਜੀ ਦੇਖ ਲਓ ਕੋਈ ਪਰਸਨ ਪੰਜ ਫਰੈਂਡ ਹਾਂ ਜੀ ਅਸੀਂ ਛੋਟੀ ਗੱਡੀ ਦੇਖ ਲਓ ਸਰ ਬਸ ਕੰਫਰਟੇਬਲ ਹੋਵੇ ਜੀ ਹਾਂਜੀ ਅਤੇ ਉੱਥੇ ਰਹਿਣ ਸਹਿਣ ਦਾ ਜੀ ਹੋ ਜਾਊਗਾ ਤੁਹਾਡੇ ਵੱਲੋਂ ਕੋਈ ਐਡਜਸਟਮੈਂਟ ਜੀ ਹਾਂਜੀ ਠੀਕ ਹੈ ਓਕੇ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਓਕੇ ਜੀ ਠੀਕ ਹੈ ਜੀ ਚੱਲੋ ਮੈਂ ਤੁਹਾਨੂੰ ਫਰੈਂਡ ਨੂੰ ਪੁੱਛ ਕੇ ਦੱਸਦਾ ਜੀ ਠੀਕ ਹੈ ਜੀ ਓਕੇ ਜੀ ਓਕੇ ਓਕੇ ਬਾਏ ਸਰ